ਜਿਵੇਂ ਕਿ ਸਾਨੂੰ ਪਤਾ ਹੈ ਭਾਰਤ ਵਿੱਚ ਕਈ ਵੱਖਰੀਆਂ ਵੱਖਰੀਆਂ ਵੈਬਸਾਈਟਾਂ ਹਨ ਜਿੱਥੋਂ ਆਪਾਂ ਖਾਣ ਪੀਣ ਦਾ ਸਮਾਨ ਮੰਗਵਾ ਸਕਦੇ ਹਾਂ ਉਹਨਾਂ ਵਿੱਚੋਂ ਇੱਕ ਵਿਸ਼ੇਸ਼ ਹੈ ਸਵੀਗੀ ਸਵੀਗੀ ਤੋਂ ਅਸੀਂ ਹਰ ਇੱਕ ਚੀਜ਼ ਖਾਣ ਪੀਣ ਵਾਲੀ ਮੰਗਵਾ ਸਕਦੇ ਹਾਂ ਜਿਵੇਂ ਕਿ ਗੁਲਾਬ ਜਾਮੁਨ ਪੀਜ਼ਾ ਬਰਗਰ ਕੇਕ ਨਿਊਡਲਸ ਆਦਿ ਆਦਿ ਹੋਰ ਵੀ ਤਰ੍ਹਾਂ ਦੀ ਡਿਸਕਾਊਂਟ ਮਿਲਦੇ ਹਨ ਜਦੋਂ ਅਸੀਂ ਕੋਈ ਵੀ ਔਰਡਰ ਪਲੇਸ ਕਰਦੇ ਹਾਂ ਇੱਥੇ ਸਾਨੂੰ ਇੱਕ ਕਈ ਤਰ੍ਹਾਂ ਹਾਂ ਔਫਰ ਸ਼ੋਅ ਕਰਦਾ ਹੈ ਜਿਵੇਂ ਅਸੀਂ ਪੀਜ਼ਾ ਮੰਗਵਾਉਣਾ ਹੈ ਪੀਜ਼ੇ ਉੱਤੇ ਕਈ ਦਿਨ ਔਫਰ ਲੱਗੀ ਹੁੰਦੀ ਹੈ ਜਿਵੇਂ ਪੀਜ਼ੇ ਦੇ ਨਾਲ ਪੀਜ਼ਾ ਫ੍ਰੀ ਕਈ ਵਕਤ ਤਾਂ ਸਾਨੂੰ ਡਿਸਕਾਊਂਟ ਵੀ ਇੰਨਾ ਮਿਲ ਜਾਂਦਾ ਹੈ ਕਿ ਜਿੱਦਾਂ ਕਿ ਅਸੀਂ ਫ੍ਰੀ 'ਚ ਫ੍ਰੀ ਵਿੱਚ ਹੀ ਖਾ ਸਕਦੇ ਹਾਂ ਹੋਰ ਜੇ ਗੱਲ ਕਰੀਏ ਤਾਂ ਜੇ ਆਪਾਂ ਪਰਚੇਸ ਕਰਦੇ ਹਾਂ ਇੱਥੋਂ ਹਜ਼ਾਰ ਰੁਪਏ ਦੀ ਤਾਂ ਸਾਨੂੰ ਤੀਹ ਪ੍ਰਸੈਂਟ ਤੱਕ ਦੀ ਵੀ ਛੂਟ ਮਿਲ ਸਕਦੀ ਹੈ ਹੋਰ ਵੀ ਗੱਲ ਕਰੀਏ ਤਾਂ ਇੱਥੇ ਜੇ ਬਰਗਰ ਖਾਣ ਜਾਈਏ ਬਰਗਰ ਵੀ ਇਹਨਾਂ ਦੇ ਬਹੁਤ ਟੇਸਟੀ ਹੁੰਦੇ ਨੇ ਅਤੇ ਜੇ ਗੱਲ ਕਰੀਏ ਆਪਾਂ ਇਹਨਾਂ ਦੇ ਡਿਲੀਵਰੀ ਦੀ ਡਿਲੀਵਰੀ ਰੇਟ ਵੀ ਬਹੁਤ ਵਧੀਆ ਰੇਟਿੰਗ ਬਹੁਤ ਵਧੀਆ ਡਿਲੀਵਰੀ ਮੈਨ ਮਿੰਟੋ ਮਿੰਟ ਘਰਾਂ ਵਿੱਚ ਆ ਕੇ ਮਿੰਟਾਂ ਸਕਿੰਟਾਂ ਵਿੱਚ ਘਰਾਂ ਵਿੱਚ ਆ ਕੇ ਸਮਾਨ ਡਿਲੀਵਰ ਕਰਕੇ ਜਾਂਦੇ ਹਨ ਅਤੇ ਨਾ ਹੀ ਕੋਈ ਟਿਪ ਮੰਗਦੇ ਹਨ ਵੱਖਰੀ ਹੋਰ ਗੱਲ ਕਰੀਏ ਤਾਂ ਇਹਨਾਂ ਦੇ ਇਹਨਾਂ ਕੋਲ ਬਹੁਤ ਸਰਵਿਸਿਜ਼ ਐਂਡ ਸਟਾਫ਼ ਬੜਾ ਕੋਅਪਰੇਟਿਵ ਹੈ ਇਹਨਾਂ ਦਾ ਨਾਲੇ ਔਫਰ ਦੀ ਗੱਲ ਕਰੀਏ ਹਰ ਇੱਕ ਚੀਜ਼ ਦੇ ਨਾਲ ਔਫਰ ਸਾਨੂੰ ਵਧੀਆ ਮਿਲਦੀ ਹੈ ਜੇ ਹੋਰ ਗੱਲ ਕਰੀਏ ਆਪਾਂ ਪੀਜ਼ਾ ਵਗੈਰਾ ਕੋਈ ਲੈਣਾ ਹੋਵੇ ਫਾਰਮ ਫਰੈੱਸ਼ ਲੈਣਾ ਹੋਵੇ ਜਾਂ ਮਗਰੇਟਾ ਲੈਣਾ ਹੋਵੇ ਫਾਰਮ ਫਰੈੱਸ਼ ਦੇ ਨਾਲ ਸਾਨੂੰ ਇਹ ਔਫਰ ਮਿਲਦੀ ਹੈ ਜੇ ਚਾਰ ਸੌ ਦੀ ਚੀਜ਼ ਹੈ ਸਾਨੂੰ ਦੋ ਸੌ 'ਚ ਪੈ ਰਹੀ ਆ ਇਹਨਾਂ ਦੇ ਕੋਲੋਂ ਅਤੇ ਨਾਲੇ ਜੇ ਮਗਰੇਟਾ ਦੀ ਗੱਲ ਕਰੀਏ ਮਗਰੇਟਾ ਦੇ ਵਿੱਚ ਸਾਨੂੰ ਇਹ ਮਿਲਦਾ ਕਿ ਅਸੀਂ ਕੋਈ ਵਧ ਮਗਰੇਟਾ ਦੇ ਵਿੱਚ ਕੋਈ ਚੀਜ਼ ਐਡ ਓਨ ਕਰਾਉਣੀ ਹੈਗੀ ਉਹ ਫ੍ਰੀ 'ਚ ਹੋਵੇਗੀ ਨਾਲੇ ਜੇ ਗੱਲ ਕਰੀਏ ਆਪਾਂ ਜੇ ਗੱਲ ਕਰੀਏ ਆਪਾਂ ਇਹਨਾਂ ਦਾ ਕੋਈ ਡਿਸਕਾਊਂਟ ਦੀ ਡਿਸਕਾਊਂਟ ਤਾਂ ਬਹੁਤ ਵਧੀਆ ਮਿਲਿਆ ਤਾਂ ਜੇਕਰ ਅਸੀਂ ਹੋਰ ਕੋਈ ਚੀਜ਼ ਲੈਣੀ ਹੋਏ ਤਾਂ ਸਵੀਗੀ ਹੀ ਪ੍ਰੈਫਰ ਕਰਾਂਗੇ ਅਤੇ ਅੰਤ ਇਹੀ ਕਹਿਣਾ ਚਾਹੂੰਗਾ ਭਾਅ ਜੀ ਮੇਰਾ ਡਿਲ ਔਰਡਰ ਛੇਤੀ ਪਲੇਸ ਕੀਤਾ ਜਾਵੇ